ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਪੀਜ਼ਾ ਪੱਜ ਤੋਂ ਬੋਲਦੇ ਜੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਅਤੇ ਨਾ ਹੀ ਆਡਰ ਕੀਤਾ ਸੀਗੇ ਤੁਹਾਡੇ ਕੋਲ ਦੋ ਬਿੱਗ ਪੀਜਾ ਦੇ ਦੋ ਬਨਾਨਾ ਸ਼ੇਕ ਭਾਅ ਜੀ ਮੈਂ ਪੁੱਛਣਾ ਸੀ ਐਕਚਲੀ ਨਾ ਕਿ ਮੈਂ ਉਹ ਉੱਤੇ ਉਹ ਲਾਉਣਾ ਭੁੱਲ ਗਿਆ ਕੋਡ ਮਤਲਬ ਜਿਹੜੇ ਹੁੰਦੇ ਨਾ ਫਰ ਵਾਲੇ ਕੋਡ ਵਾਲਾ ਲਾਉਣਾ ਭੁੱਲ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੋਈ ਔਫਰ ਵਾਲੇ ਕੋਡ ਅਵੇਲੇਬਲ ਨੇ ਉੱਤੇ ਹਾਂਜੀ ਤੁਸੀਂ ਤਾਂ ਜ਼ਰਾ ਵੈਬਸਾਈਟ ਖੋਲ੍ਹ ਕੇ ਦੋ ਹਾਂਜੀ ਭਾਅ ਜੀ ਵੈਬਸਾਈਟ 'ਤੇ ਖੋਲ੍ਹ ਕੇ ਦੱਸ ਕ ਦਿਉ ਮੈਨੂੰ ਨਾ ਐਕਚੁਲੀ ਪਤਾ ਨਹੀਂ ਚਲਦਾ ਲੱਗਦਾ ਕੀ ਪਿਆ ਕਿ ਅੱਛਾ ਜੀ ਜੇ ਮੈਂ ਦੋ ਪੀਜੇ ਮੰਗਵਾਉਂਦਾ ਤਾਂ ਤੀਹ ਪ੍ਰਸੈਂਟ ਛੂਟ ਹੈ ਅਤੇ ਜੇ ਤਿੰਨ ਮੰਗਵਾਉਂਦਾ ਤਾਂ ਚਾਲੀ ਪ੍ਰਸੈਂਟ ਅੱਛਾ ਜੇ ਔਨਲਾਈਨ ਪੇ ਕਰਦਾ ਤਾਂ ਹੋਰ ਛੂਟ ਅੱਛਾ ਅੱਛਾ ਕਿੰਨੇ ਕੁ ਛੂਟ ਹੋ ਜਾਵੇਗੀ ਹੋਰ ਓਕੇ ਪੰਜਾਹ ਪ੍ਰਸੈਂਟ ਵਾਲੀ ਪਲਸ ਫਰੀ ਡਿਲਵਰੀ ਤਾਂ ਅੱਛਾ ਤਾਂ ਮੇਰਾ ਆਡਰ ਵਗੈਰਾ ਮਤਲਬ ਸਹੀ ਹੈਗਾ ਨਾ ਜੋ ਆਡਰ ਕਰਨ ਵਾਲੀ ਨਾ ਹੋਵੇ ਆਫਰ ਕਰਕੇ ਤੁਸੀਂ ਕੁਆਂਟੀਟੀ ਵਗੈਰਾ ਘਟਾ ਦਿਉਗੇ ਅੱਛਾ ਨਹੀਂ ਭਾਅ ਜੀ ਮੈਂ ਤਾਂ ਵੈਸੇ ਤੁਹਾਡੇ ਕੋਲ ਰੈਗੂਲਰ ਮੰਗਾ ਨਾ ਦਿੰਦਾ ਕੋਈ ਦਿੱਕਤ ਨਹੀਂ ਆਈ ਅਤੇ ਉਮੀਦ ਕਰਦਾ ਕਿ ਅੱਗੇ ਵੀ ਨਹੀਂ ਆਏਗੀ ਹਾਂਜੀ ਠੀਕ ਹੈ ਭਾਅ ਜੀ ਤੁਸੀਂ ਨਾ ਔਫਰ ਕੋਡ ਮੈਨੂੰ ਲਿਖਾ ਦਿਉ ਅੱਛਾ ਕੀ ਔਫਰ ਕੋਡ ਪੀ ਐੱਨ ਬੀ ਜਮਾਟੋ ਓ ਕੇ ਓਕੇ ਠੀਕ ਆ ਭਾਅ ਜੀ ਧੰਨਵਾਦ ਜੀ ਅੱਛਾ ਔਨਲਾਈਨ ਕਰਕੇ ਆਪੇ ਹੀ ਆ ਜਾਵੇਗਾ ਠੀਕ ਆ ਭਾਅ ਜੀ ਧੰਨਵਾਦ ਜੀ ਠੀਕ ਆ ਜੀ